ਸਾਡੇ ਖੇਤਰ ਵਿੱਚ ਲੋਕ ਮਨੁੱਖ ਟੈਲੀਫੋਨ ਬਹੁਤ ਜਿਆਦਾ ਹੈ ਅੱਗੇ ਆਉਣ ਵਾਲੇ ਬੱਚੇ ਜ਼ਿਆਦਾਤਰ ਬੀਓ ਐਮਆਈ ਹਮ ਅਤੇ ਰੈਡਮੀ ਓਪੋ ਅਅਅ ਆਈਫੋਨ ਹੀ ਵਰਤਦੇ ਨੇ ਅਤੇ ਸਾਡ ਨ ਪਿੰਡ ਵਿੱਚ ਗਮ ਕਈ ਪੈਨਾਲੇ ਬੁੜਿਆ ਬਾਬਿਆਂ ਕੋਲ ਹਜੇ ਵੀ ਕੀਪੈਡ ਫੋਨ ਹੁੰਦੇ ਆ ਕੀਪੈਡ ਫੋਨ ਹੈਗੇ ਆ ਅਤੇ ਇਸ ਲਈ ਫੋਨਾਂ ਵਿੱਚ ਬਹੁਤ ਤਰ੍ਹਾਂ ਦੀਆਂ ਅ ਬਹੁਤ ਤਰ੍ਹਾਂ ਹੁਣ ਵਾਲੇ ਫੋਨਾਂ ਵਿੱਚ ਬਹੁਤ ਤਰ੍ਹਾਂ ਦੇ ਕੰਮ ਵੀ ਕੀਤੇ ਜਾਂਦੇ ਹਨ ਔਨਲਾਈਨ ਪਰ ਮੇਰੇ ਕੋਲ ਐੱਮਆਈ ਫੋਨ ਆ ਪਰ ਮੈਂ ਚ ਮੈਂ ਉਹ ਫੋਨ ਛੋਟਾ ਹੀ ਆ ਪਰ ਮੈਂ ਵੀ ਆਈਫੋਨ ਲੈਣਾ ਚਾਹੁੰਦੀ ਹਾਂ ਪਰ ਉਹ ਫੋਨ ਮੈਂ ਆਪਦੀ ਮਿਹਨਤ ਕਰਕੇ ਹੀ ਲੈਣਾ ਚਾਹੁੰਦੀ ਹਾਂ ਹਜੇ ਮੈਂ ਇਹੀ ਕਹਿੰਦੀ ਐਂ ਚਾਹੁੰਦੀ ਹਾਂ ਕਿ ਮੈਂ ਆਪਦੀ ਮਿਹਨਤ ਕਰਕੇ ਆਪਦਾ ਫੋਨ ਆਈਫੋਨ ਮੈਂ ਆਪਦੀ ਮਿਹਨਤ ਨਾਲ ਹੀ ਲਵਾਂ ਘਰਦਿਆਂ ਨੂੰ ਨਾ ਕਵਾਂ ਪਹਿਲਾ ਵਾਲੇ ਲੋਕ ਵੀ ਜਿਹੜੇ ਸੀ ਉਹ ਕੀਪੈਡ ਫੋਨਾਂ ਨਾਲ ਹੀ ਕੰਮ ਕਰਦੇ ਸਨ ਅਤੇ ਹੁਣ ਹੁਣ ਵਾਲੇ ਬ ਜਵਾਕਾਂ ਕੋਲ ਵੱਡੇ ਤੋਂ ਵੱਡਾ ਫੋਨ ਆ ਅਤੇ ਆਈਫੋਨ ਹੀ ਲੈਂਦੇ ਨੇ ਕੋਈ ਵੀ ਛੋਟਾ ਨਹੀਂ ਫੋਨ ਲੈਂਦੇ ਇਸ ਲਈ ਫੋਨਗ ਪਰ ਹੁਣ ਦੇ ਆਈਫੋਨਾਂ ਵਿੱਚ ਵੀ ਬਹੁਤ ਜ਼ਿਆਦਾ ਕੰਮ ਕੀਤੇ ਜਾਂਦੇ ਹਨ ਪੈਨ ਅਤੇ ਟੱਚਾਂ ਫੋਨਾਂ ਵਿੱਚ ਕੋਈ ਵੀ ਔਨਲਾਈਨ ਵੀ ਕੰਮ ਕਰਾਏ ਜਾਂਦੇ ਹਨ ਮੈਂ ਵੀ ਇਹ ਬਸ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਮੈਂ ਵੀ ਆਈਫੋਨ ਲਵਾਂ ਪਰ ਆਪਦੀ ਮਿਹਨਤ ਕਰਕੇ ਹੀ ਆਈਫੋਨ ਖਰੀਦ ਲਵਾਂ